ਹਾਂਜੀ ਹਾਂਜੀ ਰੈਨੋਵੇਟ ਕਰਾਉਣਾ ਤੁਸੀਂ ਜੀ ਅਸੀਂ ਰੈਨੋਵੇਟ ਕਰ ਦਾਂਗੇ ਅਤੇ ਤੁਹਾਡਾ ਸੋਫਾ ਕਿਸ ਤਰ੍ਹਾਂ ਦਾ ਹੈ ਸੋਫੇ ਦਾ ਸਾਈਜ਼ ਵਗੈਰਾ ਉਹ ਤੁਸੀਂ ਸਾਨੂੰ ਦੱਸ ਦਿਓ ਅਤੇ ਤੁਸੀਂ ਸੋਫਾ ਕਿਸ ਤਰ੍ਹਾਂ ਦਾ ਬਣਾਉਣਾ ਹੈ ਉਹਦੇ ਬਾਰੇ ਸਾਨੂੰ ਦੱਸ ਦਿਓ ਹਾਂਜੀ ਹਾਂਜੀ

ਹਾਂਜੀ ਹਾਂਜੀ ਸਾਡੇ ਕੋਲ ਬਹੁਤ ਸਾਡੇ ਕੋਲ ਬਹੁਤ ਅੋਪਸ਼ਨ ਨਹੀਂ ਆਂ ਅਤੇ ਵੱਖ ਵੱਖ ਤਰ੍ਹਾਂ ਦੇ ਸਾਡੇ ਕੋਲ ਡਿਜ਼ਾਇਨ ਹੈਗੇ ਆ ਬਹੁਤ ਤਰ੍ਹਾਂ ਦੇ ਸਾਡੇ ਕੋਲ ਜਿਹੜੇ ਕੱਪੜੇ ਹੈਗੇ ਆ ਉਹ ਸਾਡੇ ਕੋਲ ਵਧੀਆ ਟੇਲਰ ਹੈਗੇ ਆ ਜਿਹੜੇ ਕਿ ਵਧੀਆ ਵਧੀਆ ਤੁਹਾਨੂੰ ਡਿਜ਼ਇਨ ਦਿਖਾਉਣਗੇ ਅਤੇ ਜਦੋਂ ਵੀ ਤੁਹਾਨੂੰ ਲੋੜ ਹੈਗੀ ਆ ਜਿਸ ਵੀ ਤਰ੍ਹਾਂ ਦੇ ਸੋਫੇ ਡਿਜ਼ਾਇਨ ਦੀ ਤੁਹਾਨੂੰ ਲੋੜ ਹੈਗੀ ਆ ਉਹ ਅਸੀਂ ਤੁਹਾਨੂੰ ਵੱਖ ਵੱਖ ਤਰ੍ਹਾਂ ਦੇ ਜਿਹੜੇ ਡਿਜ਼ਾਇਨ ਹੈ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਅਤੇ ਤੁਸੀਂ ਆਪਣੀ ਮਰਜ਼ੀ ਨਾਲ ਤੁਸੀਂ ਆਪਣਾ ਜਿਹੜਾ ਡਿਜ਼ਾਇਨ ਆ ਉਹ ਦੇਖ ਕੇ ਆਪਣਾ ਔਡਰ ਕਰ ਸਕਦੇ ਹੋ ਦੇ ਦੇਖੋ ਜੀ ਜਿਹੜਾ ਅਸੀਂ ਰੇਟ ਲੈਂਦੇ ਹਾਂ ਉਹ ਹਮੇਸ਼ਾ ਕੱਪੜੇ ਦੇ ਹਿਸਾਬ ਨਾਲ ਲੈਂਦੇ ਹੈਗੇ ਹਾਂ ਜੇ ਅਸੀਂ ਕੱਪੜਾ ਜ਼ਿਆਦਾ ਵਧੀਆ ਕੁਆਲਿਟੀ ਦਾ ਅਤੇ ਜ਼ਿਆਦਾ ਵਧੀਆ ਟੇਲਰ ਤੋਂ ਸਵਾਉਣਾ ਹੈਗਾ ਉਹਦਾ ਅਸੀਂ ਪ੍ਰਾਈਜ਼ ਥੋੜ੍ਹਾ ਹਾਈ ਰੱਖਦੇ ਹਾਂ ਅਤੇ ਜੇ ਅਸੀਂ ਕੱਪੜਾ ਮਤਲਬ ਨੋਰਮਲ ਲੈਂਦੇ ਹੈਗੇ ਆ ਅਤੇ ਨੋਰਮਲ ਸਟੀਚਿੰਗ ਕਰਾਉਂਦੇ ਹੈਗੇ ਹਾਂ ਤਾਂ ਉਸ ਦਾ ਰੇਟ ਵੀ ਨੋਰਮਲ ਹੀ ਹੁੰਦਾ ਹੈ ਅਤੇ ਜੇ ਅਸੀਂ ਕੋਈ ਜ਼ਿਆਦਾ ਮਤਲਬ ਕਢਾਈ ਵਗੈਰਾ ਜਾਂ ਕੋਈ ਹੋਰ ਜ਼ਿਆਦਾ ਵਰਕਿੰਗ ਕਰਾਉਣੀ ਹੋਵੇ ਉਹਦੇ ਅਸੀਂ ਐਕਸਟਰਾ ਚਾਰਜ ਲੈਂਦੇ ਹਾਂ

ਬਾਕੀ ਤੁਸੀਂ ਫੋਟੋਆਂ ਭੇਜ ਦਿਓ ਤੁਸੀਂ ਸਾਡੀ ਸ਼ੋਪ 'ਤੇ ਆ ਜਿਓ ਅਸੀਂ ਜੋ ਤੁਸੀਂ ਕਹਿੰਦੇ ਮਤਲਬ ਸ਼ੋਪ 'ਤੇ ਕਰ ਲਵਾਂਗੇ